ਹੈਲੋ ਹਾਂਜੀ ਔਲਾ ਕੈਬ ਤੋਂ ਬੋਲ ਰਹੇ ਹੋ ਵੀਰੇ ਮਹਿੰਦਰ ਸਿੰਘ ਜੀ ਹਾਂਜੀ ਵੀਰੇ ਕੱਲ ਨਾ ਬੇਟੇ ਨੇ ਕੈਬ ਬੁੱਕ ਕਰਵਾਈ ਸੀ ਮਾਨਸਾ ਤੋਂ ਪਟਿਆਲੇ ਜਾਣਾ ਸੀ ਆਪਾਂ ਹਾਂਜੀ ਅੱਠ ਵਜੇ ਦਾ ਟਾਈਮ ਸੀਗਾ ਸਵਾ ਅੱਠ ਵਜ ਗਏ ਹਾਂਜੀ ਹਾਲੇ ਤੱਕ ਆਈ ਨਹੀਂ ਕੈਬ ਹਾਂਜੀ ਹਾਂਜੀ ਉਹ ਅਸਲ 'ਚ ਐਂਏ ਨਾ ਗੁੜੀਆ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡਾਕੂਮੈਂਟ ਸਬਮਿਟ ਕਰਾਉਣੇ ਨੇਗੇ ਫਿਰ ਲੇਟ ਹੋਜਾਗੇ ਦੋ ਢਾਈ ਘੰਟਿਆਂ ਦਾ ਰਸਤਾ ਵੀ ਹੈ ਤੇ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਵੀਰੇ ਪਤਾ ਕੀ ਹੈ ਲੇਟ ਜਿੰਨੀ ਹੋਈ ਜਾਵਾਂਗੇ ਟਰੈਫਿਕ ਵਧੀ ਜਾਊਗਾ ਵਾਪਿਸ ਵੀ ਆਉਣਾ ਹੈਗਾ ਨ ਨਹੀਂ ਹੋ ਤਾਂ ਫਿਰ ਤੁਸੀਂ ਦੇਖਣਾ ਸੀਗਾ ਸਾਨੂੰ ਟਾਈਮ ਤੁਸੀਂ ਦੱਸ ਦੇ ਵੀ ਇੰਨਾ ਕ ਲੇਟ ਹੋ ਸਕਦਾ ਸੀ ਹੋਰ ਕਰ ਲੈਂਦੇ ਕੈਬ ਹਾਂ ਲੋਕਲ ਦੀ ਗੱਲ ਹੋਰ ਹੁੰਦੀ ਆ ਪਟਿਆਲੇ ਜਾਣਾ ਉਥੇ ਦੋ ਤਿੰਨ ਘੰਟੇ ਲੱਗਣਗੇ ਵਾਪਿਸ ਵੀ ਆਉਣਾਗਾ ਹਾਂਜੀ ਤੁਸੀਂ ਫੋਨ ਕਰਕੇ ਪੁੱਛੋਗੇ ਮੁੰਡਾ ਕਿੰਨੇ ਕੁ ਵਜੇ ਤੱਕ ਆਉਂਦਾ ਦੇਖੋ ਸਵਾ ਅੱਠ ਤਾਂ ਹੋ ਗਏ ਜੇ ਪੰਜ ਚਾਰ ਮਿੰਟਾਂ ਤੱਕ ਆਉਂਦਾ ਤਾਂ ਸਾਨੂੰ ਦੱਸੋ ਨਹੀਂ ਫਿਰ ਅਸੀਂ ਕੋਈ ਹੋਰ ਦੇਖੀਏ ਆਪਦਾ ਹੱਲ ਕਰੀਏ ਲੇਟ ਹੋ ਜਾਂਗੇ ਅਸੀਂ ਉੱਥੇ ਨੀ ਸਾਡਾ ਕੰਮ ਬਣਨਾ ਫਿਰ ਹਾਂਜੀ ਹਾਂ ਹਾਂ ਠੀਕ ਹੈ ਨਹੀਂ ਉਹ ਤਾਂ ਗੱਲ ਠੀਕ ਹੈ ਵੀਰੇ ਜੇ ਊਂ ਜਾਣਾ ਹੁੰਦਾ ਤਾਂ ਦਸ ਪੰਦਰਾਂ ਮਿੰਟ ਦੀ ਲੋ ਕੋਈ ਗੱਲ ਨੀ ਸੀਗੀ ਐਂਏ ਆ ਨਾ ਬੱਚੇ ਨੇ ਉੱਥੇ ਸਬਮਿਟ ਕਰਾਉਦੇ ਆ ਆਪਣੇ ਡਾਕੂਮੈਂਟ ਹੋਰ ਕੋਈ ਗੱਲ ਨਹੀਂ ਹਾਂਜੀ ਤੁਸੀਂ ਮੈਨੂੰ ਹੁਣੀ ਕਾਲ ਕਰਕੇ ਦੱਸੋ ਫਿਰ ਫਿਰ ਅਸੀਂ ਦੇਖਦੇ ਆਗੇ ਵੀ ਇਤੋਂ ਤੁਸੀਂ ਕਵੋ ਵੀ ਪੰਜ ਦਸ ਮਿੰਟਾਂ ਤੱਕ ਪਹੁੰਚੇ ਹਾਂਜੀ ਹਾਂ ਹੁਣੀ ਮੈਂ ਫੋਨ ਦੀ ਵੇਟ ਕਰਦੀ ਆ ਮੈਨੂੰ ਬੈਕ ਕਾਲ ਕਰੋ ਤੁਸੀਂ ਗੱਲ ਕਰਕੇ ਠੀਕ ਹੈ ਜੀ ਓਕੇ